ਜੇਕਰ ਗੱਲ ਕਰੀਏ ਪਰਿਵਾਰਿਕ ਪਰੰਪਰਾ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਵਿੱਚ ਇੱਕ ਦੂਜੇ ਲਈ ਆਦਰ ਸਤਿਕਾਰ ਦੀ ਭਾਵਨਾ ਹੈ ਅਤੇ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਲੜਕੇ ਅਤੇ ਲੜਕੀ ਵਿੱਚ ਕੋਈ ਭੇਦ ਭਾਵ ਨਹੀਂ ਦੋਨਾਂ ਨੂੰ ਇੱਕ ਬਰਾਬਰ ਮੰਨਿਆ ਜਾਂਦਾ ਹੈ